ਮੈਂ ਆਪਣੇ ਪਿਤਾ ਜੀ ਤੋਂ ਅਤੇ ਆਪਣੇ ਦਾਦਾ ਜੀ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਬਹੁਤ ਸੁਣਿਆ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਹੈਗੇ ਆ ਜੋ ਉਹਨਾਂ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀਗੀ ਅਤੇ ਗੁਰੂ ਗੋਬਿੰਦ ਸਿੰਘ ਜੀ ਹੈਗੀਆਂ ਨੇ ਜੋ ਉਹਨਾਂ ਨੇ ਸਿੱਖੀ ਸਿਦਕ ਨੂੰ ਜਗਾਇਆ ਹੈਗਾ ਹਰੇਕ ਦੇ ਵਿੱਚ ਜਾਗਰੂਕ ਕੀਤਾ ਹੈਗਾ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਲਈ ਬਹੁਤ ਜ਼ਿਆਦਾ ਮਤਲਬ ਕਿ ਆਪਣਾ ਯੋਗਦਾਨ ਪਾਇਆ ਪੰਜਾਬ ਦੇ ਵਿਕਾਸ ਲਈ ਪੰਜਾਬ ਦਾ ਜੋ ਅੱਜ ਪੰਜਾਬ ਦਾ ਨਾਮ ਬੋਲਦਾ ਹੈਗਾ ਪਹਿਲਾਂ ਸਮਿਆਂ ਦੇ ਵਿੱਚ ਵੀ ਜੋ ਨਾਮ ਬੋਲਦਾ ਸੀ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਕਰਕੇ ਬੋਲਦਾ ਸੀਗਾ ਅਤੇ ਉਹ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਹੈਗਾ ਅਤੇ ਮੇਰੇ ਦਾਦਾ ਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਦੇ ਹੁੰਦੇ ਸੀਗੇ ਕਿ ਕਿਵੇਂ ਆਪਣੇ ਪਰਿਵਾਰ ਨੂੰ ਉਹਨਾਂ ਨੇ ਵਾਰਤਾ ਸੀ ਸਰਬੰਸ ਲਈ ਉਨ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਆਪਣੇ ਆਪ ਨੂੰ ਵਾਰਿਆ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਵਾਰਿਆ ਆਪਣੇ ਸਰਬੰਸ ਲਈ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦੀ ਕੀ ਹੈਗੀ ਸੀਗੀ ਪਰਿਵਾਰ ਨੂੰ ਵਾਰਤਾ ਸੀਗਾ ਸਾਰੇ ਪਰਿਵਾਰ ਨੂੰ ਅਤੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਸਿਖਾਇਆ ਸਾਨੂੰ ਉਹਨਾਂ ਦੇ ਵਿਚਾਰਾਂ 'ਤੇ ਚੱਲਣਾ ਚਾਹੀਦਾ ਸਾਨੂੰ ਅਤੇ ਉਹਨਾਂ ਦੀ ਜਿਹੜੀ ਮਤਲਬ ਸਿੱਖੀ ਸਿਦਕ ਨੂੰ ਆਪਣੇ ਅੰਦਰ ਹਮੇਸ਼ਾ ਪ੍ਰੇਰਿਤ ਕਰਨਾ ਚਾਹੀਦਾ ਆਪਣੇ ਆਪ ਨੂੰ ਅਤੇ ਇਸ ਲਈ ਸਾਨੂੰ ਸਭ ਨੂੰ ਕੀ ਹੈ ਉਹਨਾਂ ਦੇ ਦਿੱਤੇ ਹੋਏ ਵਿਚਾਰਾਂ 'ਤੇ ਕੀ ਹੈ ਚੱਲਣਾ ਚਾਹੀਦਾ ਹੈਗਾ ਜੀ